ਸਤਿ ਸ਼੍ਰੀ ਅਕਾਲ ਵੀਰੇ ਅੱਛਾ ਹਾਂ ਰੋਹਿਤ ਹੋਰ ਦੱਸ ਕੀ ਹਾਲ ਚਾਲ ਨੇ ਬਸ ਠੀਕ ਹੋਰ ਹਾਂ ਸਭ ਠੀਕ ਨੇ ਉਥੇ ਸਭ ਵਧੀਆ ਨੇ ਘਰੇ ਕੀ ਕਰ ਰਿਆ ਸੀ ਅੱਜ ਕੱਲ੍ਹ ਅੱਛਾ ਅੱਛਾ ਹਾਂ ਯੂਟਿਊਬ 'ਤੇ ਯੂਟਿਊਬ 'ਤੇ ਚੈਨਲ ਖੋਲਿਆ ਨਵਾਂ ਅੱਛਾ ਅੱਛਾ ਉਹ ਤਾਂ ਜਿਵੇਂ ਜਿਵੇਂ ਟਾਈਮ ਲੰਘਦਾ ਜਾਏਗਾ ਉਹ ਉਸ ਸਾਹਿਬ ਨਾਲ ਫੋਲੋਵਰ ਵਧੀ ਜਾਣਗੇ ਤੇਰੇ ਹਾਂ ਅੱਛਾ ਅੱਛਾ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਹਾਂ ਫਰੀਦਕੋਟ ਵਿੱਚ ਤੈਨੂੰ ਕਾਫ਼ੀ ਬੇਕਰੀ ਮਿਲ ਜਾਣਗੀਆਂ ਕਾਫ਼ੀ ਵਧੀਆ ਵਧੀਆ ਕੁਆਲਟੀ ਦੀਆਂ ਮਤਲਬ ਕੀ ਤੈਨੂੰ ਮਿਲ ਜਾਣਗੀਆਂ ਤੂੰ ਦੱਸ ਜਦੋਂ ਤੂੰ ਕਹੇ ਫਰੀਦਕੋਟ ਦੇ ਵਿੱਚ ਕਾਫ਼ੀ ਪੁਰਾਣੀਆਂ ਬੇਕਰੀਆਂ ਵੀ ਹੈਗੀਆਂ ਕਈ ਨਵੀਆਂ ਖੁੱਲ੍ਹੀਆਂ ਨੇ ਹੁਣ ਜਿਵੇਂ ਕਿ ਅਰਜੁਨਾ ਬੇਕਰੀ ਵਗੈਰਾ ਹੋ ਗਈ ਰਾਮਾ ਬੇਕਰੀ ਹੋ ਗਈ ਕਾਫ਼ੀ ਮਸ਼ਹੂਰ ਨੇ ਠੀਕ ਹੈ ਅਤੇ ਏਸ ਟੈਮ 'ਤੇ ਜਿਵੇਂ ਹਾਂ ਹਾਂ ਬਿਲਕੁਲ ਜਿਵੇਂ ਤੈਨੂੰ ਸਹੀ ਲੱਗੇ ਜੋ ਵੀ ਤੂੰ ਚਾਹੁੰਦਾ ਜਿਵੇਂ ਵੀ ਤੂੰ ਵੀਡੀਓ ਵਗੈਰਾ ਬਣਾਉਣੀ ਹੈ ਠੀਕ ਹੈ ਅਤੇ ਇੱਕ ਵਾਰ ਆਪਾਂ ਉਨ੍ਹਾਂ ਨਾਲ ਗੱਲ ਕਰਲਾਂਗੇ ਜਿਵੇਂ ਵੀ ਉਨ੍ਹਾਂ ਨੂੰ ਵੀ ਲੱਗੇ ਕਿ ਹਾਂ ਕੋਈ ਐਤਰਾਜ਼ ਨਾ ਹੋਵੇ ਉਨ੍ਹਾਂ ਨੂੰ ਹੂੰ ਐਤਰਾਜ਼ ਨਾ ਹੋਵੇ ਹਾਂ ਬਿਲਕੁਲ ਚੱਲ ਫੇਰ ਦੇਖਲਾਂਗੇ ਏਥੇ ਇੱਕ ਆਪਣੀ ਹੈਗੀ ਹੈ ਫਰੀਦਕੋਟ ਦੇ ਵਿੱਚ ਬੱਸ ਸਟੈਂਡ ਕੋਲ ਹੈਗੀ ਹੈ ਡ੍ਰੀਮ ਬੇਕਰਸ ਉਹ ਹੈਗੇ ਨੇ ਥੋੜ੍ਹੀ ਜਾਣ ਪਛਾਣ ਹੈਗੀ ਉਨ੍ਹਾਂ ਨਾਲ ਵੀ ਅਤੇ ਉਨ੍ਹਾਂ ਦਾ ਵਿਹਾਰ ਵੀ ਕਾਫ਼ੀ ਚੰਗਾ ਹੈ ਅਤੇ ਉਨ੍ਹਾਂ ਨਾਲ ਆਪਾਂ ਗੱਲ ਕਰਲਾਂਗੇ ਅਤੇ ਇੱਕ ਤਾਂ ਇਹ ਕਿ ਤੇਰੀ ਵੀਡੀਓ ਬਣ ਜਾਵੇਗੀ ਨਾਲੇ ਇਹ ਕਿ ਉਨ੍ਹਾਂ ਦਾ ਵੀ ਥੋੜ੍ਹੀ ਉਹ ਹੋਜੇਗੀ ਪਬਲੀਸਿਟੀ ਹੋਜੇਗੀ ਹਾਂ ਬਿਲਕੁਲ ਬਿਲਕੁਲ ਬਿਲਕੁਲ ਨਾਲੇ ਅੱਜ ਕੱਲ੍ਹ ਤਾਂ ਫ੍ਰੀ ਦੇ ਵਿੱਚ ਸਾਰੇ ਚਾਹੁੰਦੇ ਹੈਗੇ ਪਬਲੀਸਿਟੀ ਹੋਵੇ ਅਤੇ ਵਧੀਆ ਉਨ੍ਹਾਂ ਦਾ ਵੀ ਥੋੜ੍ਹੀ ਮਸ਼ਹੂਰੀ ਹੋਜੇਗੀ ਮੈਂ ਇਸ ਟੈਮ ਫ੍ਰੀ ਸੀਗਾ ਤੂੰ ਦੇਖ ਲੈ ਜੇ ਟਾਈਮ ਹੈਗਾ ਤੇਰੇ ਕੋਲ ਤਾਂ ਤੂੰ ਹੁਣੀ ਆ ਜਾ ਕੱਲ੍ਹ ਮੈਂ ਹਾਂ ਸ਼ਾ

ਹਾਂ ਬਿਲਕੁਲ ਬਿਲਕੁਲ ਨਾਲੇ ਰਾਤ ਦੇ ਟੈਮ 'ਤੇ ਥੋੜ੍ਹੀ ਵੀਡੀਓ ਵਧੀਆ ਬਣੇਗੀ ਲਾਈਟਾਂ ਵਗੈਰਾ ਨਾਲ ਅਤੇ ਕੋਈ ਨਹੀਂ ਤੂੰ ਤੁਰ ਪਾ ਤੇ ਮੈਨੂੰ ਜਦੋਂ ਪਹੁੰਚਣ ਲੱਗਾ ਤਾਂ ਮੈਨੂੰ ਫੋਨ ਕਰ ਦੇਈਂ ਇੱਕ ਵਾਰ

ਹਾਂ ਮੈਂ ਬਸ ਹੁਣੇ ਫੋਨ ਕਰਕੇ ਪੁੱਛ ਰਿਹਾ ਉਨ੍ਹਾਂ ਨੂੰ ਹੈਂ ਨਹੀਂ ਨਹੀਂ ਹਾਂ ਮੈਂ ਸਾਰਾ ਕੁਛ ਪੁੱਛ ਕੇ ਰੱਖ ਲੈਂਦਾ ਮੈਂ ਅਤੇ ਤੂੰ ਆ ਜਾ ਠੀਕ ਹੈ ਜੀ ਓਕੇ ਜੀ ਸਤਿ ਸ਼੍ਰੀ ਅਕਾਲ